ਹੈਲੋ ਹਾਂਜੀ ਨਮਸਕਾਰ ਤਰੁਨ ਐਚੁਲੀ ਮੈਂ ਤੁਹਾਨੂੰ ਪੁੱਛਣਾ ਸੀ ਕਿ ਮੈਂ ਮਲੇਸ਼ੀਆ ਦੇ ਪੈਕੇਜ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕੀ ਤੁਸੀਂ ਉਹਦੀ ਜਾਣਕਾਰੀ ਦੇ ਸਕਦੇ ਹੋ ਮੈਨੂੰ ਹਾਂਜੀ ਹਾਂਜੀ ਹਾਂਜੀ ਜ਼ਰੂਰ ਸਰ ਅਸੀਂ ਸਰ ਦੋ ਜਣੇ ਮੈਂ ਔਰ ਮੇਰੇ ਹਸਬੈਂਡ ਅਸੀਂ ਸਰ ਵਨ ਵੀਕ ਦਾ ਹੀ ਹੋਵੇਗਾ ਹਾਂਜੀ ਅਸੀਂ ਸਰ ਦਿਸੰਬਰ ਦੇ ਲਾਸਟ ਵੀਕ ਹਾਂਜੀ ਹਾਂਜੀ ਜ਼ਰੂਰ ਸਰ ਓਕੇ ਓਕੇ ਹਾਂਜੀ ਹਾਂਜੀ ਭਈਆ ਸਰ ਵੈਸੇ ਤਾਂ ਰਿਲੈਕਸ ਮੋਡ ਦਾ ਹੀ ਹੈ ਬੱਟ ਇਹ ਹੈ ਕੀ ਅਗਰ ਕੋਈ ਅਡਵੈਂਚਰ ਵੀ ਹੋ ਜਾਵੇ ਤਾਂ ਉਹਦੇ ਵਿੱਚ ਮਤਲਬ ਅਸੀਂ ਉਹਦੇ 'ਚ ਵੀ ਇੰਟ੍ਰਸਟ ਜ਼ਰੂਰ ਲੈਣਾ ਚਾਹਵਾਂਗੇ ਹਾਂਜੀ ਠੀਕ ਹੈ ਸਰ ਥ੍ਰੀ ਸਟਾਰ ਸਰ ਥ੍ਰੀ ਸਟਾਰ ਠੀਕ ਹੈ ਓ ਓਕੇ ਓਕੇ ਓਕੇ ਓਕੇ ਪੈਰਾਗਲਾਈਡਿੰਗ ਸਰ ਮੈਂ ਤਾਂ ਨਹੀਂ ਮੇਰੇ ਹਸਬੈਂਡ ਜ਼ਰੂਰ ਇੰਟ੍ਰਸਟਡ ਹੋਣਗੇ ਇਹਦੇ ਵਿੱਚ ਉਹ ਜ਼ਰੂਰ ਕਰ ਲੈਣਗੇ ਹਾਂਜੀ ਹਾਂਜੀ ਓਕੇ ਓਕੇ ਓਕੇ ਜ਼ਰੂਰ ਸਰ ਪੂਰੀ ਹੈਲਪ ਕਰੋ ਤਾਂ ਬਹੁਤ ਵਧੀਆ ਹੋਵੇਗਾ ਹਾਂਜੀ ਜ਼ਰੂਰ ਸਰ ਇਸ ਹੀ ਨੰਬਰ ਤੇ ਠੀਕ ਹੈ ਹਾਂਜੀ ਥੈਂਕ ਯੂ ਓਕੇ